ਮੈਂ ਇਹ ਸੋਚਦੀ ਹਾਂ ਕਿ ਮੇਰੀ ਲਿਖਤ ਦੂਜੇ ਲੇਖਤਾਂ ਲੇਖਕਾਂ ਤੋਂ ਵੱਖਰੀ ਹੈ ਮੈਂ ਇਸ ਕਰਕੇ ਸੋਚਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਸਪੱਸ਼ਟ ਰੂਪ ਵਿੱਚ ਆਪਣੀ ਲਿਖਤੀ ਕਰਦੀ ਹਾਂ ਤਾਂ ਜੋ ਪੜ੍ਹਨ ਵਾਲੇ ਨੂੰ ਸਹੀ ਸੰਦੇਸ਼ਾ ਪ੍ਰਾਪਤ ਹੋ ਸਕੇ ਜਿਸ ਕਰਕੇ ਉਹ ਸਪੱਸ਼ਟ ਰੂਪ ਵਿੱਚ ਮੇਰੀ ਲਿਖਤਾਂ ਨੂੰ ਪੜ੍ਹ ਕੇ ਉਹਨਾਂ 'ਤੇ ਅਮਲ ਕਰ ਸਕਣ ਮੇਰੀ ਲਿਖਤੀ ਵਿਚਾਰਸ਼ੀਲ ਹੁੰਦੀ ਹੈ ਮੇਰੀ ਲਿਖਤੀ ਸੁੰਦਰ ਅਤੇ ਅਨੋਖੇ ਤ ਤਜ਼ਰਬੇ ਪ੍ਰਸਤੁਤ ਕਰਦੀ ਹੈ ਮੈਂ ਵਿਅਕਤੀਗਤ ਹੋਣ ਦੇ ਨਾਲ ਨਾਲ ਵਿਚਾਰਸ਼ੀਲ ਅਤੇ ਸਮਰਪਿਤ ਵੀ ਹਾਂ ਮੇਰੀ ਲਿਖਾਈ ਵਿੱਚ ਪੜ੍ਹਨ ਵਾਲੇ ਆਪਣੇ ਆਪ ਨੂੰ ਅਹਿਮ ਹਿੱਸਾ ਸਮਝ ਕੇ ਪੜ੍ਹਦੇ ਹਨ ਜਿਸ ਕਰਕੇ ਉਹਨਾਂ ਨੂੰ ਇਹ ਮਨ ਮਨੋਰੰਜਨ ਭਰਪੂਰ ਲੱਗਦੀ ਹੈ ਅਤੇ ਉਹਨਾਂ ਨੂੰ ਇਹ ਕਿਰਦਾਰ ਮਨ ਭਾਉਂਦੇ ਹਾਂ ਮੈਂ ਆਪਣੀ ਲਿਖਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਜਿਵੇਂ ਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੀ ਹਾਂ ਜਿਸ ਨਾਲ ਮੈਨੂੰ ਵਧੀਆ ਲਿਖਣ ਦਾ ਅਨੁਭਵ ਹੁੰਦਾ ਰਹਿੰਦਾ ਹੈ ਮੈਂ ਕਈ ਲੇਖਕਾਂ ਦੀ ਕਿਤਾਬਾਂ ਅੱਜ ਤੱਕ ਪੜ੍ਹੀਆਂ ਜਿਹਨਾਂ ਤੋਂ ਮੈਨੂੰ ਭਰਪੂਰ ਗਿਆਨ ਵੀ ਪ੍ਰਾਪਤ ਹੋਇਆ ਮੈਂ ਆਪਣੀ ਲਿਖਤਾਂ ਵਿੱਚ ਵਾਕ ਸਪੱਸ਼ਟ ਅਤੇ ਸਾਫ਼ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਇਸ ਤਰ੍ਹਾਂ ਮੈਂ ਆਪਣੀ ਲਿਖਤ ਨੂੰ ਸੁਧਾਰ ਸਕਦੀ ਹਾਂ ਅਤੇ ਆਪਣੇ ਲਿਖਤ ਨੂੰ ਵਿਚਾਰਸ਼ੀਲ ਬਣਾਉਣ ਵਿੱਚ ਹੋਰ ਵੀ ਮਦਦ ਕਰ ਸਕਦੀ ਹਾਂ